ਹਾਜੀ ਹਾਂਜੀ ਸਤਿ ਸ਼੍ਰੀ ਅਕਾਲ ਮੈਮ ਕੈਸੇ ਹੈ ਆਪ ਮੈਂ ਵੀ ਠੀਕ ਆ ਹਾਂਜੀ ਮੈਮ ਐਕਚੁਲੀ ਮੈਂ ਪੁੱਛਣਾ ਸੀ ਤੁਹਾਡੇ ਕੋਲੋਂ ਕਿ ਜਿਹੜਾ ਵੰਨ ਵੀਕ ਦਾ ਕਰੀਕੁਲਮ ਆ ਉਹ ਤੁਸੀਂ ਪਾਠਕ੍ਰਮ ਅਤੇ ਲੈਸਨ ਪਲੈਨ ਵਗੈਰਾ ਤਿਆਰ ਕਰ ਲਿਆ ਅੱਛਾ ਕਿਸ ਸਮੇਂ ਕਿੰਨਾ ਕੁ ਸਿਲੇਬਸ ਰੱਖਿਆ ਜੇ ਕੀ ਇੱਕ ਹਫ਼ਤੇ ਵਾਸਤੇ ਅੱਛਾ ਅੱਛਾ ਅਤੇ ਕਿੰਨੀ ਕੁ ਲੈਂਥ 'ਚ ਚੈਪਟਰ ਮੀਨਜ਼ ਜ਼ਿਆਦਾ ਲੈਂਥੀ ਤਾਂ ਨਹੀਂ ਆ ਹਮ ਹਮ ਹਾਂਜੀ ਸ਼ਬਦ ਅਰਥ ਵੀ ਹੋਣਗੇ ਅਤੇ ਵੰਨ ਵੀਕ 'ਚ ਹੋ ਜੇਗਾ ਪੂਰਾ ਕੰਪਲੀਟ ਹਾਂਜੀ ਇਹ ਕੁਛ ਜ਼ਿਆਦਾ ਨਹੀਂ ਮੰਨ ਲਉ ਲੇਖ ਵੀ ਲੇਖ ਦੀ ਲੈਂਥ ਵੀ ਹੋਏਗੀ ਲੰਬਾ ਵੀ ਹੋਏਗਾ ਲੇਖ ਹੈ ਨਾ ਅਤੇ ਉਹ ਫਿਰ ਬੱਚੇ ਕੋਪੀ 'ਤੇ ਲਿਖਣਗੇ ਸਾਡਾ ਚੈਕਿੰਗ ਵਰਕ ਵੀ ਹੋਊਗਾ ਹੈ ਨਾ ਅਤੇ ਮੈਂ ਸੋਚਦੀ ਨਾਲ ਮੰਨ ਲਉ ਜਿਵੇਂ ਤੁਸੀਂ ਇੱਕ ਪਾਠ ਵੀ ਕਰਵਾਉਣਾ ਵਾ ਅਤੇ ਗ੍ਰੈਮਰ ਦਾ ਵੀ ਕਾਫੀ ਲੈ ਲਿਆ ਵਾ ਵੰ ਇੱਕ ਹਫਤੇ ਵਾਸਤੇ ਅਤੇ ਫਿਰ ਬੱਚੇ ਦੀ ਨੋਟਬੁੱਕ ਚੈੱਕ ਵੀ ਹੋਣੀ ਆ ਅਤੇ ਸਹੀ ਹੈ ਮੀਨਜ਼ ਇੰਨਾ ਕੰਪਲੀਟ ਹੋ ਜਾਊਗਾ ਅੱਛਾ ਅੱਛਾ ਅੱਛਾ ਅੱਛਾ ਚਲੋ ਠੀਕ ਹੈ ਰਵੀਜ਼ਨ ਹੈ ਮਤਲਬ ਹੈ ਨਾ ਅੱਛਾ ਅੱਛਾ ਚਲੋ ਠੀਕ ਆ ਹੈ ਨਾ ਨਾਲ ਨਾਲ ਮੀਨਜ਼ ਜਿਵੇਂ ਥੋੜ੍ਹਾ ਬਹੁਤਾ ਲੈਸਨ ਪਲੈਨ 'ਚ ਦੇ ਅਕੋਰਡਿੰਗ ਜਿੰਨਾ ਵੀ ਤੁਸੀਂ ਆਪਣਾ ਕਰੋਂਗੇ ਡਿਸਾਈਡ ਉਹਦੇ ਅਕੋਰਡਿੰਗ ਥੋੜ੍ਹਾ ਥੋੜ੍ਹਾ ਕੰਮ ਕਰਵਾ ਕੇ ਨਾ ਅਤੇ ਬੱਚਿਆਂ ਕੋਲ ਫੀਡਬੈਕ ਵੀ ਲੈਂਦੇ ਰਿਹੋ ਥੋੜ੍ਹੇ ਥੋੜ੍ਹੇ ਨਾਲ ਨਾਲ ਹੈ ਨਾ ਜਾ ਕੇ ਉਹਨਾਂ ਦੀ ਚੰਗੀ ਤਰ੍ਹਾਂ ਰਵੀਜ਼ਨ ਹੋ ਜੇਗੀ

ਹੋਰ ਕੋਈ ਦਿੱਕਤ ਤੁਹਾਨੂੰ ਕੋਈ ਦਿੱਕਤ ਤਾਂ ਨਹੀਂ ਹੋਜੇ ਬਸ ਵਧੀਆ ਚੱਲਦਾ ਪਿਆ ਅਤੇ ਧਿਆਨ ਨਾਲ ਫਿਰ ਤੁਸੀਂ ਆਪਣਾ ਇਹ ਵੇਖ ਲਿਓ ਕਰ ਲਿਓ ਹੈਨਾ ਇਹ ਲਿੰਗ ਵਚਨ ਦੋਨੋਂ ਸ਼ਾਮਿਲ ਕਰਨੇ ਤੁਸੀਂ ਅੱਛਾ ਲਿੰਗ ਵਚਨ ਦੋੋਨੋਂ ਸ਼ਾਮਿਲ ਇਹ ਰਿਪੀਟ ਤਾਂ ਨਹੀਂ ਹੈ ਨਾ ਫਸਟ ਟਾਈਮ ਹੀ ਹੋਣੀ ਸ਼ਾਮਿਲ ਐਸੇ ਟਰਮ ਦੇ ਵਿੱਚ ਹੀ ਹੈ ਨਾ ਚਲੋ ਠੀਕ ਆ ਜੀ ਕਿਆ ਹੋਰ ਓਕੇ ਓਕੇ ਜੀ ਥੈਂਕ ਯੂ